ਹੈਲੋ ਹਾਂਜੀ ਕਿੰਗ ਰੈਸਟੋਰੈਂਟ ਤੋਂ ਬੋਲ ਰਹੇ ਜੀ ਹਾਂਜੀ ਅਸੀਂ ਨਾ ਮਾਡਲ ਟਾਊਨ ਕਪੂਰਥਲਾ ਤੋਂ ਬੋਲ ਰਹੇ ਹਾਂ ਜੀ ਹਾਊਸ ਨੰਬਰ ਸੱਤ ਸੌ ਗਿਆਰ੍ਹਾਂ ਤੋਂ ਸਾਡਾ ਇੱਕ ਆਰਡਰ ਸੀਗਾ ਅਸੀਂ ਆਰਡਰ ਦੇਣਾ ਸੀਗਾ ਜੀ ਹਾਂਜੀ ਤੁਸੀਂ ਆਡਰ ਨੋਟ ਕਰ ਲਿਓ ਜੀ ਦੋ ਸ਼ਾਹੀ ਪਨੀਰ ਦੋ ਕੜਾਹੀ ਪਨੀਰ ਅਤੇ ਦੋ ਪਲੇਟਾਂ ਹੀ ਦਾਲ ਮੱਖਣੀ ਦੀਆਂ ਕਰ ਦਿਓ ਅਤੇ ਇੱਕ ਵੀਹ ਨਾਨ ਪੈਕ ਕਰ ਦਿਓ ਅਤੇ ਮਿੱਠੇ ਦੇ ਵਿੱਚ ਤੁਸੀਂ ਪੰਜ ਪਲੇਟਾਂ ਰਸ ਮਲਾਈ ਦੀਆਂ ਅਤੇ ਅੱਧਾ ਕਿਲੋ ਗੁਲਾਬ ਜਾਮਣ ਪੈਕ ਕਰ ਦਿਓ ਜੀ ਅਤੇ ਇਹਦੀ ਪੇਮੈਂਟ ਜਿਹੜੀ ਆ ਉਹ ਦੱਸ ਦਿਓ ਜੀ ਕਿੰਨੀ ਹੋਈ ਇਹਦੀ ਪੇਮੈਂਟ ਹੋ ਗਈ ਜੀ ਅੱਛਾ ਜੀ ਠੀਕ ਹੈ ਜੀ ਕੋਈ ਨਹੀਂ ਸਰ ਮੈਂ ਨਾ ਜਿਹੜਾ ਬਾਈ ਸੌ ਆ ਇਹਦਾ ਸਾਰਾ ਪੇਮੈਂਟ ਕਰ ਦਿਆਂ ਕਿ ਬਾ ਬਾਅਦ 'ਚ ਕਰਾਂ ਥੋੜ੍ਹੀ ਪੇਮੈਂਟ ਹਾਂ ਅੱਧੀ ਪਹਿਲਾਂ ਕਰ ਦਿਆਂ ਕਿ ਅੱਧੀ ਬਾਅਦ 'ਚ ਕਰਾਂ ਅੱਛਾ ਮੈਂ ਚਲੋ ਮੈਂ ਸਾਰੀ ਪੇਮੈਂਟ ਜਿਹੜੀ ਆ ਉਹ ਮੈਂ ਪਹਿਲਾਂ ਕਰ ਰਿਹਾ ਤੁਸੀਂ ਆਪਣਾ ਮੈਨੂੰ ਕੋਈ ਫੋਟੋ ਦੇ ਸਕਦੇ ਹੋ ਉਹ ਦੇ ਸਕਦੇ ਹੋ ਆਪਣਾ ਆਈ ਡੀ ਜਿਸ 'ਤੇ ਮੈਂ ਆਪਣੀ ਪੇਮੈਂਟ ਕਰ ਦਿਆਂ ਓਕੇ ਠੀਕ ਹੈ ਸਰ ਤੁਸੀਂ ਨਾ ਥੋੜ੍ਹੀ ਪੰਜ ਜਾਂ ਦਸ ਮਿੰਟ ਦੇ ਵਿੱਚ ਚੈੱਕ ਕਰ ਲਿਓ ਜੀ ਮੈਂ ਤੁਹਾਨੂੰ ਜਿਹੜੀ ਆ ਤੁਹਾਡੀ ਪੂਰੀ ਪੇਮੈਂਟ ਪਹਿਲਾਂ ਹੀ ਕਰ ਰਿਹਾਂ ਐਡਵਾਂਸ ਅਤੇ ਮੇਰਾ ਫੂਡ ਜਿਹੜਾ ਆ ਉਹ ਠੰਡਾ ਨਾ ਹੋਵੇ ਉਹਨੂੰ ਟਾਈਮ 'ਤੇ ਪਲੀਜ਼ ਤੁਸੀਂ ਮੇਰੇ ਪਹੁੰਚਾ ਦਿਓ ਠੀਕ ਹੈ ਜੀ ਧੰਨਵਾਦ ਜੀ ਸ਼ੁਕਰੀਆ